ਹੈਲੋ ਹਾਂ ਭਾਈ ਕੌਣ ਬੋਲਦਾ ਭਾਈ ਕਿਹੜੇ ਸਕੂਲ 'ਚ ਭਾਈ ਤੁਸੀਂ ਕੰਮ ਕਰਦੇ ਹੋ ਅੱਛਾ ਚੰਗਾ ਸਕੂਲ ਭਾਈ ਠੀਕ ਹੈ ਆਪਾਂ ਬੱਚੇ ਪੜ੍ਹਾਉਣ ਲਾਉਣੇ ਸੀ ਭਾਈ ਠੀਕ ਹੈ ਕੀ ਮੀਡੀਅਮ ਚੱਲਦਾ ਹੈਗਾ ਮੀਡੀਅਮ ਕੀ ਚੱਲਦਾ ਠੀਕ ਹੈ ਬੱਚੇ ਛੋਟੇ ਨੇਗੇ ਆ ਜੀ ਹਾਂ ਦੋ ਬੱਚੇ ਵੱਡੇ ਨੇ ਤੀਜੀ ਚੌਥੀ 'ਚ ਇਹ ਕੋਈ ਬੈਨ ਵਗੈਰਾ ਦਾ ਠੀਕ ਆ ਡੇਲੀ ਸਰਵਿਸ ਆ ਵੈਨਾਂ ਦੀ ਖਰਚਾ ਖੁਰਚਾ ਵੈਨਾਂ ਦਾ ਕਿੰਨਾ ਆ ਭਾਈ ਠੀਕ ਹੈ ਠੀਕ ਹੈ ਠੀਕ ਹੈ ਅਤੇ ਨਰਸਰੀ ਦੀ ਪ੍ਰਾਇਮਰੀ ਦੀ ਕੀ ਫੀਸ ਹੈ ਨਰਸਰੀ ਪ੍ਰਾਇਮਰੀ ਵਗੈਰਾ ਦੀ ਕੀ ਫੀਸ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਠੀਕ ਹੈ ਗੇਮਾਂ ਵਗੈਰਾ ਵੀ ਚੱਲਦੀਆਂ ਹੋਣਗੀਆਂ ਭਾਈ ਗੇਮਾਂ ਵਗੈਰਾ ਦਾ ਵੀ ਪ੍ਰਬੰਧ ਹੋਊ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇੰਡੋਰ ਗੇਮਾਂ ਹੀ ਨੇ ਬਸ ਮਤਲਬ ਮਤਲਬ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇੰਸਟੀਟਿਊਸ਼ਨ ਕਿਨ ਕਿੰਨੇ ਕੁ ਚਿਰ ਦਾ ਚੱਲਦਾ ਭਾਈ ਇੰਸਟੀਟਿਊਸ਼ਨ ਤੁਹਾਡਾ ਕ ਕਿੰਨੇ ਕੁ ਚਿਰ ਤੋਂ ਚੱਲਦਾ ਹੈਗਾ ਅੱਛਾ ਕਾਫੀ ਪੁਰਾਣਾ ਫਿਰ ਤਾਂ ਫਿਰ ਤਾਂ ਵਧੀਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ ਫਿਰ ਅਸੀਂ ਦੋ ਤਿੰਨ ਦਿਨਾਂ ਨੂੰ ਤੁਹਾਨੂੰ ਕੋਲ ਆਵਾਂਗੇ ਮਾਹੌਲ ਦੇਖ ਕੇ ਫਿਰ ਬੱਚਿਆਂ ਦਾ ਦਾਖਲਾ ਕਰਵਾਵਾਂਗੇ ਭਾਈ ਠੀਕ ਹੈ ਸਤਿ ਸ਼੍ਰੀ ਅਕਾਲ ਧੰਨਵਾਦ